ਬਰਤਨ ਸਾਫ਼ ਕਰਨ ਦੇ ਲਈ ਜੋ ਸਾਬਣ ਦੀ ਵਰਤੋਂ ਜਿਹਨੂੰ ਅਸੀਂ ਵਿੰਮ ਬਾਰ ਵੀ ਕਹਿ ਦਿੰਦੇ ਹਾਂ ਜਾਂ ਫਿਰ ਜੋ ਤਰਲ ਸਾਬਣ ਹੈ ਸ਼ੀਸ਼ੀ ਦੇ ਵਿੱਚ ਉਹਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਅਤੇ ਸਰਦੀ ਦੇ ਵਿੱਚ ਗਰਮ ਪਾਣੀ ਦੀ ਵਰਤੋਂ ਨਾਲ ਬਰਤਨ ਧੋਣ ਦੀ ਪ੍ਰਕਿਰਿਆ ਹੋਰ ਵੀ ਸਹਿਜ ਹੋ ਸਕਦੀ ਹੈ ਸੋ ਪਾਣੀ ਜੋ ਤੇਲ ਜਾਂ ਚਿਕਨਾਈ ਨੂੰ ਸਾਫ਼ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ ਤਾਂ ਕਿ ਬਰਤਨ ਪੂਰੀ ਤਰ੍ਹਾਂ ਸਾਫ਼ ਹੋ ਕੇ ਮੁੜ ਵਰਤੋਂ ਯੋਗ ਹੋ ਸਕੇ